ਬਰਤਨ ਧੋਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਬਰਤਨਾਂ ਨੂੰ ਸਾਫ ਪਾਣੀ ਦੇ ਨਾਲ ਸਾਫ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਹੀ ਤੁਸੀਂ ਉਸਦੇ ਉੱਤੇ ਸਰਫ਼ ਜਾਂ ਡਿਟੇਰਜ਼ਟ ਜੋ ਵੀ ਲਗਾਉਣਾ ਚਾਹੁੰਦੇ ਹੋ ਉਹ ਲਗਾ ਸਕਦੇ ਹੋ ਪਰ ਸਾਨੂੰ ਜੋ ਇਹਨਾਂ ਬਰਤਨਾਂ ਦੇ ਵਿੱਚ ਤੇਲ ਲੱਗਿਆ ਹੁੰਦਾ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਗਰਮ ਪਾਣੀ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਅਤੇ ਗਰਮ ਪਾਣੀ ਦੇ ਨਾਲ ਜੋ ਤੇਲ ਵਾਲੇ ਬਰਤਨ ਹਨ ਬਾਕੀ ਡਿਟਰਜ਼ੈਂਟ ਲਗਾ ਕੇ ਉਹ ਜਲਦੀ ਸਾਫ ਹੋ ਜਾਂਦੇ ਹਨ